ਮੇਰੇ ਸਕੂਲ ਵਿੱਚ ਬਹੁਤ ਤਰ੍ਹਾਂ ਦੇ ਫੰਕਸ਼ਨ ਹੁੰਦੇ ਸੀ ਅਤੇ ਮੈਂ ਉਹਨਾਂ ਵਿੱਚ ਹਿੱਸਾ ਲੈਂਦਾ ਸੀ ਮੈਨੂੰ ਅੱਜ ਵੀ ਯਾਦ ਹਾਂ ਜਦੋਂ ਮੈਂ ਸਿੰਗਿੰਗ ਕੰਮਪੀਟੀਸ਼ਨ ਵਿੱਚ ਭਾਗ ਲਿਆ ਸੀ ਅਤੇ ਮੈਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ